ਮੈਂ ਆਪਣੇ ਬੁਣਾਈ ਦੇ ਵਿੱਚ ਵਰਧਮਾਨ ਧਾਗੇ ਉੱਨ ਦਾ ਜ਼ਿਆਦਾ ਇਸਤੇਮਾਲ ਕਰਨਾ ਚਾਹੁੰਦੀ ਕਿਉਂਕੀ ਉਹ ਬਹੁਤ ਜ਼ਿਆਦਾ ਸੋਫਟ ਅਤੇ ਅੱਛੀ ਹੁੰਦੀ ਹੈ ਅਤੇ ਮੈਂ ਜ਼ਿਆਦਾਤਰ ਕਰੋਸ਼ੀਏ ਦੇ ਨਾਲ ਹੀ ਬਣਾਉਂਦੀ ਹੈਗੀ ਹਾਂ ਚੀਜ਼ ਕੁਛ ਵੀ ਕਰੋਸ਼ੀਏ ਦਾ ਮੈਂ ਟੋਪੀਆਂ ਥਾਲਪੋਸ਼ ਵਗੈਰਾ ਭਗਵਾਨ ਦੇ ਚੋਲੇ ਅਤੇ ਬੱਚਿਆਂ ਦਾ ਵੀ ਕੁਛ ਨਾ ਕੁਛ ਬਣਾਉਂਦੀ ਰਹਿੰਦੀ ਹਾਂ ਅਤੇ ਇੱਕ ਵਾਰ ਮੈਂ ਆਹਾ ਸਲਾਈ ਦੇ ਵਿੱਚ ਮੋਜੇ ਬਣਾਉਣੇ ਕੀਤੇ ਸ਼ੁਰੂ ਉਹਦੇ ਵਿੱਚ ਤਾਂ ਮੈਨੂੰ ਇੰਨੀ ਮਤਲਬ ਮੁਸ਼ਕਲ ਆਈ ਨਾ ਬਣਾਉਣ ਵਾਸਤੇ ਉਹਦੇ ਜਿਹੜਾ ਅੰਗੂਠਾ ਬਣਾਉਂਦੇ ਉਹਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਮੈਨੂੰ ਮੁਸ਼ਕਲ ਆਈ ਹੈ ਬਹੁਤ ਜੱਦੋ ਜਹਿਦ ਕਰਨ ਕਰਨੀ ਪਈ ਪਰ ਚਲੋ ਮੈਂ ਫਿਰ ਵੀ ਬਣਾ ਲਿੱਤੀ ਅਤੇ ਇੱਕ ਵਾਰ ਮੈਂ ਆਪਣੀ ਕੁੜੀ ਲਈ ਉਹ ਕਲੱਚਰ ਕਲਿਪ ਬਣਾਇਆ ਉੱਨ ਦਾ ਕਰੋਸ਼ੀਏ ਦੇ ਨਾਲੇ ਕਹਿੰਦੀ ਮੰਮੀ ਮੈਨੂੰ ਉਹ ਉਹ ਬਣਾ ਕੇ ਦੇਵੋ ਉਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਬੁਣਨ ਦੇ ਵਿੱਚ ਤੰਗੀ ਆਈ ਪਰ ਫਿਰ ਵੀ ਮੈਂ ਉਹ ਬਣਾ ਦਿੱਤਾ ਪਰ ਸਿੱਖਣਾ ਮਤਲਬ ਨਵੇਂ ਨਵੇਂ ਤਰੀਕੇ ਸਿੱਖਣਾ ਅੱਛਾ ਲੱਗਦਾ ਹੈਗਾ ਬੱਚਿਆਂ ਦਾ ਇਹ ਕਹਿੰਦੀ ਮੰਮੀ ਮੈਨੂੰ ਉਹ ਹੀ ਬਣਾ ਕੇ ਦਿਓ ਪਰ ਮੈਂ ਫਿਰ ਵੀ ਬਣਾ ਦਿੱਤਾ ਬਲੈਕ ਐਂਡ ਵਾਈਟ ਦੀ ਉਹਦੇ ਵਿੱਚ ਉੱਨ ਲਗਾਈ ਉਹ ਇੰਨੀ ਸੋਹਣੀ ਖਿਲੀ ਨਾ ਨਿੱਚੇ ਕਲੱਚਰ ਚਿਪਕਾ ਤਾ ਗੂੰਦ ਦੇ ਨਾਲ ਸਾਰੇ ਇਹਦੇ ਫਰੈਂਡਾਂ ਪੁੱਛਣ ਵੀ ਇਹ ਕਿਸ ਤੋਂ ਬਣਵਾਇਆ ਜਦੋਂ ਇਹਨੇ ਦੱਸਿਆਂ ਵੀ ਮੰਮੀ ਨੇ ਬਣਾਇਆ ਸਾਰੇ ਹੈਰਾਨ ਹੋ ਗਏ ਬਹੁਤ ਅੱਛੀ ਤਰ੍ਹਾਂ ਕੀਤਾ ਬਣਾਇਆ ਮੈਂ ਫਿਰ